ਜਿਵੇਂ ਕਿ ਵੱਧ ਰਹੀ ਆਬਾਦੀ ਨਾਲ ਟੈਕਨੋਲਜੀ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਦਿਨ ਬ ਦਿਨ ਰੋਜ਼ ਦੇ ਰੋਜ਼ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਪਿੰਡੋਂ ਸ਼ਹਿਰੋਂ ਕਿਸੇ ਦੇਸ਼ ਵਿੱਚੋਂ ਉੱਠਿਆ ਹੀ ਰਹਿੰਦਾ ਹੈ ਆਪਣੀ ਮਿਹਨਤ ਦੇ ਸਦਕਾ ਉਹ ਕਿਸੇ ਨਾ ਕਿਸੇ ਪੌੜੀ 'ਤੇ ਚੜ੍ਹਿਆ ਰਹਿੰਦਾ ਹੈ ਇਸ ਪ੍ਰਕਾਰ ਸਾਨੂੰ ਇਨ੍ਹਾਂ ਹੀ ਵਿੱਚ ਚੁਣੀਂਦੇ ਲੋਕਾਂ ਵਿੱਚੋਂ ਸਾਨੂੰ ਐਪਸ ਦੀ ਵਰਤੋਂ ਕਰਨ ਨੂੰ ਮਿਲੀ ਹੈ ਸਾਡੇ ਮੋਬਾਈਲਾਂ ਵਿੱਚ ਸਾਡੇ ਕੋਲ ਸ ਸਾਰੇ ਤਰ੍ਹਾਂ ਦੇ ਐਪ ਹਨ ਜਿਨ੍ਹਾਂ ਦੀ ਵਰਤੋਂ ਨਾਲ ਸਾਡੇ ਕੰਮ ਬਹੁਤ ਆਸਾਨ ਹੋ ਜਾਂਦੇ ਹਨ ਜਿਵੇਂ ਆਪਾਂ ਕੋਈ ਵੀ ਟ੍ਰੇਨ ਬੁੱਕ ਕਰਨੀ ਹੋਵੇ ਔਨਲਾਈਨ ਜਾਂ ਆਪਾਂ ਕਿਸੇ ਵੀ ਸਫਰ 'ਤੇ ਜਾਣਾ ਹੋਵੇ ਜਾਂ ਕਾਰ 'ਤੇ ਜਾਣਾ ਹੋਵੇ ਬਸ 'ਤੇ ਜਾਣਾ ਹੋਵੇ ਕਿਤੇ ਵੀ ਜਾਣਾ ਹੋਵੇ ਬਾਈਕ 'ਤੇ ਜਾਣਾ ਹੋਵੇ ਕਿਤੇ ਵੀ ਜਾਣਾ ਹੋਵੇ ਸਾਨੂੰ ਔਨਲਾਈਨ ਇਹਨਾਂ ਦੇ ਐਪ ਉਪਲਬਧ ਹਨ ਅਸੀਂ ਕਿਸੇ ਵੀ ਐਪ ਤੋਂ ਆਪਣੀ ਟ੍ਰੇਨ ਬੁੱਕ ਕਰਵਾ ਸਕਦੇ ਹਾਂ ਸਾਨੂੰ ਉਹਨਾਂ ਐਪਾਂ ਦੁਆਰਾ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਟ੍ਰੇਨ ਕਿਹੜੇ ਸਟੇਸ਼ਨ ਤੋਂ ਤੁਰਨੀ ਹੈ ਅਤੇ ਕਿਹੜੇ ਸਟੇਸ਼ਨ ਤੱਕ ਪਹੁੰਚਣੀ ਹੈ ਅਤੇ ਉਸਨੇ ਕਿੰਨਾ ਸਫਰ ਪੈਦਾ ਕਰਨਾ ਹੈ ਅਤੇ ਆਪਾਂ ਕਿੰਨੇ ਟਾਈਮ ਤੱਕ ਉੱਥੇ ਪਹੁੰਚ ਸਕਦੇ ਹਾਂ ਇਸ ਤੋਂ ਇਲਾਵਾ ਇੰਸਟਾਗ੍ਰਾਮ ਹੋ ਗਿਆ ਇਸ ਤੋਂ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਵੀਹ ਤੋਂ ਪਹਿਲ ਥੱਲੇ ਥੱਲੇ ਜਿਹੜੇ ਸਾਲ ਹਨ ਉਹ ਇਹਨਾਂ ਦੀ ਵਰਤੋਂ ਕਰਦੇ ਹਨ ਆਪਣਾ ਟਾਈਮ ਪਾਸ ਕਰਨ ਲਈ ਫੇਸਬੁੱਕ ਹੋ ਗਿਆ ਇਹਨਾਂ 'ਤੇ ਨਿਊਜ਼ ਬਹੁਤ ਜ਼ਿਆਦਾ ਆਉਂਦੀ ਹੈ ਕੋਈ ਨਾ ਕੋਈ ਉੱਠਿਆ ਰਹਿੰਦਾ ਹੈ ਕੋਈ ਨਾ ਕੋਈ ਨਵਾਂ ਕੋਂਟੈਂਟ ਲੈ ਕੇ ਟੈਲੀਗ੍ਰਾਮ ਹੋ ਗਿਆ ਇੱਥੋਂ ਵੀ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਸਾਨੂੰ ਫੇਸਬੁੱਕ ਤੋਂ ਨਹੀਂ ਪਤਾ ਲੱਗਦੀਆਂ ਇੰਸਟਾਗ੍ਰਾਮ ਪਰ ਨਹੀਂ ਪਤਾ ਲੱਗਦੀਆਂ ਉਹ ਸਾਨੂੰ ਟੈਲੀਗ੍ਰਾਮ ਤੋਂ ਪਤਾ ਲੱਗਦੀਆਂ ਹਨ ਅਤੇ ਆਪਾਂ ਗੇਮਿੰਗ ਵੀ ਬਹੁਤ ਵਧੀਆ ਐਪ ਹਨ ਇਹਦੇ ਵਿੱਚ ਆਪਾਂ ਜੇ ਬੋਰ ਹੋ ਰਹੀਏ ਹੋਈਏ ਸਾਡਾ ਟਾਈਮ ਨਾ ਹੋ ਰਿਹਾ ਹੋਵੇ ਤਾਂ ਆਪਾਂ ਗੇਮਾਂ ਖੇਡ ਕੇ ਆਪਣਾ ਟਾਈਮ ਬਤੀਤ ਕਰ ਸਕਦੇ ਹਾਂ